ਭਾਰਤ ਇੱਕ ਅਜਿਹਾ ਦੇਸ਼ ਹੈ ਜਿੱਥੇ ਘੁੰਮਣ ਦੇ ਨਾਲ ਨਾਲ ਸਾਡੇ ਸੁਤੰਤਰਤਾ ਸੈਨਾਨੀਆਂ ਬਾਰੇ ਦੱਸਿਆ ਗਿਆ ਹੈ ਇੱਥੇ ਲੋਕ ਬੜੀ ਦੂਰ ਦੂਰ ਤੋਂ ਘੁੰਮਣ ਆਉਂਦੇ ਹਨ ਜਿਵੇਂ ਸ਼ਿਮਲਾ ਮਨਾਲੀ ਜਾਂ ਕਈ ਬੋਡਰ 'ਤੇ ਪਰੇਡ ਦੇਖਣ ਜਾਣਾ ਜ਼ਿਆਦਾ ਪਸੰਦ ਕਰਦੇ ਹਨ ਜੇਕਰ ਗੱਲ ਕਰੀਏ ਅੱਜ ਕੱਲ ਕਿ ਅਜਿਹੇ ਲੋਕ ਹਨ ਜੋ ਕਿ ਹੁਸੈਨੀਵਾਲਾ ਬੋਡਰ ਫਿਰੋਜ਼ਪੁਰ ਹੈ ਉੱਥੇ ਸ਼ਹੀਦਾਂ ਨੂੰ ਪ੍ਰਣਾਮ ਕਰਨ ਜਾਂਦੇ ਹਨ ਰਾਜਗੁਰੂ ਸੁਖਦੇਵ ਅਤੇ ਭਗਤ ਸਿੰਘ ਕਈ ਲੋਕ ਤਾਂ ਅਟਾਰੀ ਵਾਹਗਾ ਬੋਡਰ ਵੀ ਦੇਖਣ ਜਾਂਦੇ ਹਨ ਜਿੱਥੇ ਕਿ ਉਹ ਸ਼ਾਮ ਨੂੰ ਇੰਡੀਆ ਅਤੇ ਪਾਕਿਸਤਾਨ ਦੀ ਪਰੇਡ ਦੇਖਦੇ ਹਨ ਜਿਸਨੂੰ ਦੇਖ ਕੇ ਬਹੁਤ ਹੀ ਖੁਸ਼ੀ ਮਿਲਦੀ ਹੈ ਅਤੇ ਬਹੁਤ ਹੀ ਅਨੰਦ ਆਉਂਦਾ ਹੈ ਅਤੇ ਕਈ ਲੋਕ ਤਾਂ ਜੂ ਦੇਖਣ ਚੱਲ ਜਾਂਦੇ ਹਨ ਉਹਨਾਂ ਨੂੰ ਜੂ ਦੇਖਣਾ ਜ਼ਿਆਦਾ ਪਸੰਦ ਹੁੰਦਾ ਹੈ ਜਿਸ ਵਿੱਚ ਉਹ ਵੱਖ ਵੱਖ ਤਰ੍ਹਾਂ ਦੇ ਜਾਨਵਰ ਦੇਖਦੇ ਹਨ